ਰੂਪਨਗਰ ਜ਼ਿਲ੍ਹੇ ਵਿੱਚ ਸਥਾਨਕ ਸਰਕਾਰ ਸਰਕਾਰਾਂ ਅਤੇ ਰਾਜਨੀਤਿਕ ਢਾਂਚੇ ਵਿੱਚ ਇਹ ਦੇਖ ਸ ਦੇਖਿਆ ਗਿਆ ਹੈ ਕਿ ਅਮਰਜੀਤ ਸਿੰਘ ਸੰਦੋਆ ਜੋ ਐਮ ਐਲ ਏ ਅਨੰਦਪੁਰ ਸਾਹਿਬ ਦਾ ਹੈ ਜੋ ਕਿ ਰੇਤਾ ਵੇਚਦਾ ਹੇਇਆ ਫੜਿਆ ਗਿਆ ਇਸਦੀ ਜੁੱਤੀਆਂ ਮਾਰਦੇ ਦੀ ਵੀਡਿਓ ਵੀ ਵਾਇਰਲ ਹੋਈ ਜੋ ਕਿ ਪਹਿਲਾਂ ਕਹਿੰਦਾ ਸੀ ਕਿ ਇਹ ਜ਼ਿਲ੍ਹੇ ਲਈ ਬਹੁਤ ਕੁਛ ਕਰੇਗਾ ਪਰ ਮੀਡੀਆ ਦੁਆਰਾ ਵੀ ਇਹ ਦੱਸਿਆ ਗਿਆ ਕਿ ਇਹ ਬਹੁਤ ਕੁਛ ਕਰੇਗਾ ਪਰ ਇਸ ਨੇ ਕੁਛ ਨਹੀਂ ਕੀਤਾ ਦੁਸਰੇ ਪਾਸੇ ਦਿਨੇਸ਼ ਚੱਢਾ ਜੋ ਜ਼ਿਲ੍ਹੇ ਜ਼ਿਲ੍ਹੇ ਜ਼ਿਲ੍ਹੇ ਦਾ ਪ੍ਰਸ਼ਾਸਨ ਬਣਨ ਲਈ ਵੋਟਾਂ ਦੀ ਮੰਗ ਕਰਦਾ ਹੈ ਘਰ ਘਰ ਜਾ ਕੇ ਪਰ ਉਹ ਉਸ ਉਸਨੇ ਕੁਛ ਨਹੀਂ ਕੀਤਾ ਗਲ਼ੀਆਂ ਦੀ ਹਾਲਤ ਬਹੁਤ ਖਰਾਬ ਹੈ ਰਾ ਐਨ ਗਲ਼ੀਆਂ ਵਿੱਚ ਹਨੇਰਾ ਰਹਿੰਦਾ ਹੈ ਰਾਤ ਨੂੰ ਜਾਨਵਰ ਆਉਂਦੇ ਰਹਿੰਦੇ ਹੈ ਟੋਏ ਪੁੱਟੇ ਹੋਏ ਹਨ ਜਗ੍ਹਾ ਜਗ੍ਹਾ 'ਤੇ ਬਿਲਕੁਲ ਵੀ ਸੁਧਾਰ ਨਹੀਂ ਕੀਤਾ ਹੈਗਾ ਜ਼ਿ ਜ਼ਿਲ੍ਹੇ ਲਈ